ਸਾਡੇ ਇਲਾਕੇ ਵਿੱਚ ਭਾਈਚਾਰਕ ਸੰਸਥਾਵਾਂ ਬਹੁਤ ਹਨ ਜਿਵੇਂ ਕਿ ਗੱਲ ਕਰੀਏ ਸਭ ਤੋਂ ਪਹਿਲੇ ਨੰਬਰ 'ਤੇ ਨਾਮ ਆਉਂਦਾ ਹੈ ਪ੍ਰਭ ਆਸਰੇ ਦਾ ਜਿੱਥੇ ਕਿ ਅਨਾਥ ਬੱਚਿਆਂ ਨੂੰ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਉਹਨਾਂ ਨੂੰ ਪੜ੍ਹਾਇਆ ਵੀ ਜਾਂਦਾ ਹੈ ਉਹਨਾਂ ਵਿੱਚੋਂ ਕਈ ਬੱਚੇ ਪੜ੍ਹ ਲਿਖ ਕੇ ਵਧੀਆ ਅਹੁਦੇ 'ਤੇ ਲੱਗੇ ਹੋਏ ਹਨ ਜਿਵੇਂ ਕਿ ਕਈ ਡਾਕਟਰ ਬਣੇ ਹਨ ਕਈ ਬੱਚਿਆਂ ਨੂੰ ਟੀਚਰ ਬਣ ਗਏ ਹੈ ਅਤੇ ਬੱਚਿਆਂ ਨੂੰ ਪੜ੍ਹਾ ਰਹੇ ਹਨ ਅਤੇ ਪ੍ਰਭ ਆਸਰੇ ਦਾ ਨਾਮ ਉੱਚਾ ਕਰ ਰਹੇ ਹਨ ਅਤੇ ਕਈ ਬੱਚਿਆਂ ਨੇ ਪੜ੍ਹ ਲਿਖ ਕੇ ਉੱਥੇ ਹੀ ਜੋ ਅਪਾਹਜ ਬੱਚੇ ਹਨ ਉਹਨਾਂ ਦੇ ਟਰੀਟਮੈਂਟ ਕਰ ਰਹੇ ਹਨ ਦੂਜੇ ਨੰਬਰ 'ਤੇ ਆਉਂਦਾ ਹੈ ਕਰਤਾਰ ਬਿਰਧ ਆਸ਼ਰਮ ਜਿੱਥੇ ਕਿ ਬੁਢਾਪ ਬੁੱਢੇ ਜੋ ਹੋ ਗਏ ਬੇਘਰ ਜਾਂ ਜਿਹਨਾਂ ਦੇ ਪਰਿਵਾਰਾਂ ਨੇ ਉਹਨਾਂ ਨੂੰ ਥਾਂ ਨਹੀਂ ਦਿੱਤੀ ਉਹਨਾਂ ਨੂੰ ਉੱਥੇ ਰੱਖਿਆ ਜਾਂਦਾ ਹੈ ਅਤੇ ਉਹਨਾਂ ਦੀ ਪਾਲਣ ਪੋਸ਼ਣ ਕੀਤਾ ਜਾਂਦਾ ਅਤੇ ਉਹਨਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਉਹਨਾਂ ਦੀ ਦੇਖਭਾਲ ਕੀਤੀ ਜਾਂਦੀ ਹੈ ਗੱਲ ਕਰੀ ਜਾਵੇ ਹੋਰ ਸੰਸਥਾਵਾਂ ਦੀ ਜਿਵੇਂ ਕਿ ਛੋਟੇ ਬੱਚਿਆਂ ਵਾਸਤੇ ਸਕੂਲ ਹੋ ਗਏ ਅਤੇ ਉਹਨਾਂ ਨੂੰ ਫ੍ਰੀ ਵਿੱਚ ਪੜ੍ਹਾਇਆ ਜਾਂਦਾ ਹੈ ਜਿਵੇਂ ਕਿ ਅੱਠਵੀਂ ਜਮਾਤ ਤੱਕ ਉਹਨਾਂ ਨੂੰ ਕੋਈ ਵੀ ਫੀਸ ਨਹੀਂ ਲਈ ਜਾਂਦੀ ਅਤੇ ਕੁੜੀਆਂ ਵਾਸਤੇ ਜੋ ਕਿ ਸਰਕਾਰ ਵੱਲੋਂ ਵੀ ਅਤੇ ਸੰਸਥਾਵਾਂ ਵੱਲੋਂ ਵੀ ਕਈਆਂ ਵਿੱਚ ਉਹਨਾਂ ਨੂੰ ਫ੍ਰੀ ਪੜ੍ਹਾਇਆ ਜਾਂਦਾ ਹੈ ਅਤੇ ਸਾਇਕਲ ਵੀ ਵੰਡੇ ਜਾਂਦੇ ਹਨ ਇਹ ਹਨ ਜੋ ਕੀ ਸਾਡੇ ਜ਼ਿਲ੍ਹੇ ਵਿੱਚ ਭਾਈਚਾਰਕ ਸੰਸਥਾਵਾਂ ਜਾਂ ਚੈਰਿਟੀ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੋਇਆ